ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜਾ ਪੰਜਾਬੀ ਗੱਭਰੂਆਂ ਦਾ ਪਾਇਆ ਜਾਣ ਵਾਲਾ ਇੱਕ ਬਹੁਤ ਹੀ ਮਹੱਤਵਪੂਰਨ ਲੋਕ ਨਾਚ ਹੈ ਭੰਗੜਾ ਹਰ ਵਿਆਹਾਂ ਸ਼ਾਦੀਆਂ ਅਤੇ ਮੇਲਿਆਂ ਤਿਉਹਾਰਾਂ 'ਤੇ ਪੰਜਾਬੀਆਂ ਦੁਆਰਾ ਪਾਇਆ ਜਾਂਦਾ ਹੈ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਭੰਗੜਾ ਪਾਇਆ ਜਾਂਦਾ ਹੈ ਮੇਲਿਆਂ ਤਿਉਹਾਰਾਂ ਅਤੇ ਹਰ ਖੁਸ਼ੀ ਵਿੱਚ ਭੰਗੜਾ ਪਾਇਆ ਜਾਂਦਾ ਹੈ ਅਤੇ ਭੰਗੜਾ ਪੰਜਾਬੀਆਂ ਦੇ ਸੱਭਿਆਚਾਰ ਦਾ ਇੱਕ ਮੁੱਢਲਾ ਅੰਗ ਹੈ ਸਮੇਂ ਦੇ ਨਾਲ ਨਾਲ ਇਹ ਪੰਜਾਬ ਦੇ ਤਿਉਹਾਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਪੰਜਾਬ ਦੇ ਤਿਉਹਾਰ ਬਿਨ੍ਹਾਂ ਭੰਗੜੇ ਤੋਂ ਬਿਨ੍ਹਾਂ ਅਧੂਰੇ ਲੱਗਦੇ ਹਨ ਭੰਗੜਾ ਢੋਲ ਦੇ ਨਾਲ ਪਾਇਆ ਜਾਂਦਾ ਹੈ ਢੋਲ ਇੱਕ ਸਾਜ ਹੈ ਜਿਸਨੂੰ ਵਜਾਉਂਦੇ ਹਨ ਅਤੇ ਨਾਲ ਉਸਦੇ ਭੰਗੜਾ ਪਾਉਂਦੇ ਹਨ ਸਮੇਂ ਦੇ ਨਾਲ ਨਾਲ ਜੋ ਪੰਜਾਬ ਦੇ ਤਿਉਹਾਰ ਹਨ ਉਹਨਾਂ ਦੇ ਵਿੱਚ ਭੰਗੜਾ ਨੇ ਆਪਣੀ ਜਗ੍ਹਾ ਬਹੁਤ ਹੀ ਮਹੱਤਵਪੂਰਨ ਬਣਾ ਲਈ ਹੈ ਉਹ ਇਸ ਤਰ੍ਹਾਂ ਕਿ ਭੰਗੜਾ ਬਦਲ ਕੋਨਿਆਂ ਅਤੇ ਹੋਰ ਅਤੇ ਜਸ਼ਨ ਵਾਲੇ ਹਰ ਮੌਕੇ 'ਤੇ ਪਾਇਆ ਜਾਂਦਾ ਹੈ